ਹਰ ਖੇਤਰ ਵਿੱਚ ਕੋਈ ਨਾ ਕੋਈ ਪਕਵਾਨ ਮਸ਼ਹੂਰ ਹੁੰਦਾ ਹੈ ਸਾਡੇ ਪਾਸੇ ਦੀ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਸਾਰੇ ਪੰਜਾਬ ਵਿੱਚ ਮਸ਼ਹੂਰ ਹੈ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਸਰਦੀਆਂ ਵਿੱਚ ਬਣਾਇਆ ਜਾਂਦਾ ਹੈ ਅਤੇ ਇਹਨੂੰ ਗਰਮ ਗਰਮ ਖਾਧਾ ਜਾਂਦਾ ਹੈ ਮੱਕੀ ਦੀ ਰੋਟੀ ਦੇ ਇਲਾਵਾ ਬਾਜਰੇ ਦੀ ਰੋਟੀ ਵੀ ਇੱਧਰ ਚੰਗੀ ਬਣਦੀ ਹੈ ਇਹਦੇ ਨਾਲ ਦਾਲ ਮੱਖਣੀ ਵੀ ਸਾਰੇ ਸਾਲ ਬਾਰ੍ਹਾਂ ਮਹੀਨੇ ਖਾਧੀ ਜਾਂਦੀ ਆ ਦਾਲ ਮੱਖਣੀ ਨੂੰ ਆਪਾਂ ਜਿਹੜੀ ਲੰਗਰ ਵਾਲੀ ਦਾਲ ਜਾਂ ਮਾਂਹ ਦੀ ਦਾਲ ਵੀ ਕਹਿੰਦੇ ਨੇ ਬਸ ਜਿਹੜੀ ਦਾਲ ਸਾਡੀ ਮਸ਼ਹੂਰ ਹੈ ਉਸ 'ਚ ਕਾਫੀ ਮੱਖਣ ਪੈਂਦਾ ਹੈ ਇਸ ਤੋਂ ਇਲਾਵਾ ਲੱਸੀ ਪੰਜਾਬ ਦਾ ਸਭ ਤੋਂ ਮਸ਼ਹੂਰ ਡਰਿੰਕ ਹੈ